ਪੰਜਾਬ 'ਚ ਸਿੱਖਿਆ ਪ੍ਰਣਾਲੀ ਪਹਿਲਾਂ ਨਾਲੋਂ ਬਹੁਤ ਤਰੱਕੀ ਕਰ ਰਹੀ ਹੈ ਪਹਿਲਾਂ ਦੇ ਮੁਕਾਬਲੇ ਵਿਚ ਹੁਣ ਅੱਜ ਕੱਲ੍ਹ ਸਮਾਰਟ ਕਲਾਸਰੂਮ ਬਣਾਏ ਜਾਂਦੇ ਨੇ ਸਕੂਲਾਂ ਦੇ ਵਿੱਚ ਕੰਪਿਊਟਰ ਦੀ ਫੈਸਿਲਿਟੀਸ ਵੀ ਦਿੱਤੀਆਂ ਗਈਆਂ ਨੇ ਗਰੀਬ ਬੱਚਿਆਂ ਨੂੰ ਟੈਬ ਵਗੈਰਾ ਵੀ ਦਿੱਤੀਆਂ ਜਾਂਦੀਆਂ ਨੇ ਸਕੂਲਾਂ ਦੇ ਵਿੱਚ ਅਤੇ ਕੰਪਿਊਟਰ ਦੇ ਨਾ ਨੂੰ ਵੀ ਦੇ ਰਾਹੀਂ ਪੜ੍ਹਾਇਆ ਜਾਂਦਾ ਕੰਪਿਊਟਰ ਦੇ ਜ਼ਰੀਏ ਜਿਹਦੇ ਕਰਕੇ ਬੱਚਿਆਂ ਨੂੰ ਜਲਦੀ ਸਮਝ ਆ ਜਾਂਦਾ ਪ੍ਰੈਕਟੀਕਲ ਕਰਵਾ ਕੇ ਦੇਖਿਆ ਜਾਂਦਾ ਨਵੀਆਂ ਤਕਨੀਕਾਂ ਜਿਹੜੀਆਂ ਨੇ ਉਹ ਸਕੂਲਾਂ ਵਿੱਚ ਲਾਗੂ ਕੀਤੀਆਂ ਗਈਆਂ ਨੇ ਟੀਚਰਾਂ ਨੂੰ ਵੀ ਕੰਪਿਊਟਰ ਦੇ ਰਾਹੀਂ ਪੜ੍ਹਾਉਣ ਦੀ ਹਿਦਾਇਤ ਕੀਤੀ ਜਾਂਦੀ ਹੈ ਉਹਨਾਂ ਦੇ ਅ ਪਹਿਲਾਂ ਟੀਚਰ ਵੀ ਕੰਪਿਊਟਰ ਚਲਾਉਣਾ ਨਹੀਂ ਜਾਣਦੇ ਸੀ ਹੁਣ ਪੁਰਾਣੇ ਜਿਹੜੇ ਟੀਚਰ ਨੇ ਉਹਨਾਂ ਨੂੰ ਵੀ ਕੰਪਿਊਟਰ ਦੀ ਟ੍ਰੇਨਿੰਗ ਦਿੱਤੀ ਗਈ ਹੈ ਜਿਹਦੇ ਨਾਲ ਉਹ ਵੀ ਹੁਣ ਸੁਖਾਲੇ ਤਰੀਕੇ ਦੇ ਨਾਲ ਬੱਚਿਆਂ ਨੂੰ ਸੁਖਾਲੇ ਢੰਗ ਦੇ ਨਾਲ ਸਮਝਾ ਦਿੰਦੇ ਨੇ ਅਤੇ ਬੱਚੇ ਬਹੁਤ ਤਰੀਕੇ ਵਧੀਆ ਤਰੀਕੇ ਦੇ ਨਾਲ ਆਸਾਨੀ ਦੇ ਨਾਲ ਸਮਝ ਜਾਂਦੇ ਨੇ ਪਹਿਲਾਂ ਨਾਲੋਂ ਸਾਡੇ ਬੱਚੇ ਇਸ ਪੱਧਰ 'ਤੇ ਜ਼ਿਆਦਾ ਤਰੱਕੀ ਕਰ ਰਹੇ ਨੇ